ਉਹਨਾਂ ਲਈ ਵੀ ਵੱਖ ਵੱਖ ਟੀਕਿਆਂ ਦੀ ਟੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਸਾਰਿਆਂ ਦੀ ਵੱਖਰੀ ਵੱਖਰੀ ਹੀ ਮਹੱਤਤਾ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਸਾਰੇ ਹੀ ਟੀਕੇ ਲਗਵਾਉਣੇ ਚਾਹੀਦੇ ਹਨ ਜਿਵੇਂ ਕਿ ਮਹਾਂਮਾਰੀ ਦੇ ਟੀਕੇ ਵਾਸਤੇ ਉਹਨਾਂ ਨੂੰ ਐਫ ਵਾਇਰਸ ਲਗਵਾਉਣਾ ਚਾਹੀਦਾ ਹੈ ਜੇ ਉਹਨਾਂ ਨੂੰ ਇਨਫੈਕਸ਼ਨ ਹੋ ਜਾਵੇ ਤਾਂ ਉਸ ਨਾਲ ਨੂੰ ਰੈਬਿਜ ਅਤੇ ਟੈਟਨਸ ਦੇ ਟੀਕਾ ਲਗਵਾਉਣੇ ਚਾਹੀਦੇ ਹਨ ਅਤੇ ਜੇ ਉਹਨਾਂ ਦੇ ਵਿੱਚ ਜਿਵੇਂ ਬੈਕਟੀਰੀਆ ਅਤੇ ਉਹਨਾਂ ਦੇ ਜੇਕਰ ਬੈਕ ਬੈਕਟੀਰੀਆ ਅਤੇ ਵਾਇਰਸ ਨੂੰ ਰੋਕਣ ਵਾਸਤੇ ਵੀ ਵੱਖਰੇ ਵੱਖਰੇ ਟੀਕੇ ਆਉਂਦੇ ਹਨ ਜਿਵੇਂ ਕਿ ਬੋਰੋਟਾਇਲੈਸ ਪਰੋਵਾਇਰਸ ਹੁਣ ਹੁੰਦੇ ਹਨ ਅਤੇ ਇਮੀਨੀਅਸ ਉਹਨਾਂ ਦੇ ਇਮੁਨਸ ਸਿਸਟਮ ਵਾਸਤੇ ਵੀ ਸਾਨੂੰ ਵਕ ਮਤਲਵ ਉਹਨਾ ਨਾਲ ਦਵਾਈ ਵੀ ਸਾਨੂੰ ਸੰਭਾਲ ਕਰਨੀ ਚਾਹੀਦੀ ਉਹਨਾਂ ਦੇ ਵੱਖਰੇ ਵੱਖਰੇ ਟੀਕੇ ਉਹਨਾਂ ਨੂੰ ਲਵਾਉਣੇ ਚਾਹੀਦੇ ਹਨ ਅਤੇ ਬ ਉਹਨਾਂ ਦੇ ਪਸ਼ੂਆਂ ਦੀ ਸਾਨੂੰ ਬਹੁਤ ਜ਼ਿਆਦਾ ਸੰਭਾਲ ਕਰਨੀ ਚਾਹੀਦੀ ਹੈ ਉਹਨਾਂ ਦੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿਉਂ ਕਿਉਂਕਿ ਸਾਨੂੰ ਸਾਨੂੰ ਪਸ਼ੂਆਂ ਤੋਂ ਸਾਨੂੰ ਦੁੱਧ ਮਿਲਦਾ ਹੈ ਅਤੇ ਉਹਨਾਂ ਦੀ ਸਾਡੀ ਸ ਉਹਨਾਂ ਦੀ ਸੰਭਾਲ ਸਾਡੀ ਬਹੁਤ ਜ਼ਰੂਰੀ ਉਹਨਾਂ ਦੀ ਸਾਫ਼ ਸਫਾਈ ਦਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਚਾਰੇ ਦਾ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਹਨਾਂ ਦਾ ਮਤਲਬ ਟਾਈਮ ਟਾਈਮ ਦੇ ਆ ਕੇ ਉਹਨਾਂ ਨੂੰ ਟੀਕੇ ਲਵਾਉਣੇ ਚਾਹੀਦੇ ਹਨ ਅਤੇ ਤਾਂ ਕਿ ਉਹ ਆਪਣੇ ਉਹ ਆਪਣਾ ਉਹ ਤੰਦਰੁਸਤ ਰਹਿ ਸਕਣ ਅਤੇ ਸਾਨੂੰ ਆਪਣਾ ਦੁੱਧ ਦੇ ਸਕਣ ਉਹਨਾਂ ਨੂੰ ਚਾਰਾ ਵਗੈਰਾ ਉਹਨਾਂ ਨੂੰ ਖਲ੍ਹ ਵੀ ਪਾਈ ਜਾਂਦੀ ਹੈ ਖਲ੍ਹ ਮਤਲਬ ਤੂੜੀ ਦੇ ਵਿੱਚ ਮਿਕਸ ਕਰਕੇ ਖਲ੍ਹ ਮਿਕਸ ਕਰਕੇ ਉਹਨਾਂ ਨੂੰ ਉਹ ਪਾਈ ਜਾਂਦੀ ਹੈ ਤਾਂ ਕਿ ਉਹ ਸਾਨੂੰ ਦੁੱਧ ਜ਼ਿਆਦਾ ਦੇਣ ਮੱਝਾਂ ਦੀ ਸੰਭਾਲ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਉਹਨਾਂ ਦੀ ਸਾਫ਼ ਸਫਾਈ ਦਾ ਉਹਨਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਅਤੇ ਉਹਨਾਂ ਦੀ ਉਹਨਾਂ ਦੀ ਟਾਈਮ ਟਾਈਮ ਦੇ ਆ ਕੇ ਉਹਨਾਂ ਨੂੰ ਟੀਕੇ ਵਗੈਰਾ ਵੀ ਲਵਾਉਣੇ ਚਾਹੀਦੇ ਹਨ ਤਾਂ ਕਿ ਉਹ ਉਹ ਤੰਦਰੁਸਤ ਰਹਿਣ ਅਤੇ ਸਾਨੂੰ ਆਪਣਾ ਵਧੀਆ ਦੁੱਧ ਦੇ ਸਕਣ